ਹਾਂ ਮੈਂ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲਿਆ ਹੈ ਅਤੇ ਮੇਰਾ ਤਜ਼ਰਬਾ ਬਹੁਤ ਹੀ ਵਧੀਆ ਰਿਹਾ ਸੀ ਅਪਣੇ ਸਕੂਲ ਦੇ ਸਮੇਂ ਵਿੱਚ ਮੈਂ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ ਮੈਂ ਉਸ ਸਮੇਂ ਦਾ ਤਜ਼ਰਬਾ ਬਿਆਨ ਕਰਦੀ ਹਾਂ ਮੈਂ ਉਸ ਵੇਲੇ ਮਲਕੀ ਕੀਮਾ ਨਾਮ ਦੇ ਪਾਤਰ 'ਤੇ ਅਧਾਰਿਤ ਰੋਲ ਅਦਾ ਕੀਤਾ ਸੀ ਮੈਂ ਉਸ ਡਰਾਮੇ ਵਿੱਚ ਮਲਕੀ ਬਣੀ ਸੀ ਅਤੇ ਮੇਰੀ ਜਮਾਤ ਦੀ ਇੱਕ ਹੋਰ ਕੁੜੀ ਕੀਮਾ ਬਣੀ ਸੀ ਉਸ ਵੇਲੇ ਉਹ ਮੁੰਡੇ ਦੀ ਭੇਸ਼ ਭੂਸ਼ਾ ਧਾਰਨ ਕੀਤੀ ਸੀ ਅਧਿਆਪਕਾਂ ਨੇ ਦਸ ਦਿਨ ਤੱਕ ਇਸ ਡਰਾਮੇ ਦੀ ਰਿਹਰਸਲ ਸਾਨੂੰ ਕਰਵਾਈ ਸੀ ਫੰਕਸ਼ਨ ਵਾਲੇ ਦਿਨ ਅਸੀਂ ਬਹੁਤ ਡਰੇ ਹੋਏ ਸੀ ਕਿਉਂਕਿ ਇਹ ਸਾਡਾ ਪਹਿਲਾ ਤਜ਼ਰਬਾ ਸੀ ਕੋਈ ਵੀ ਸਕਿੱਟ ਕਰਨ ਦੇ ਬਾਰੇ ਅਸੀ ਚੀਜ਼ ਨੂੰ ਲੈ ਕੇ ਵੀ ਬਹੁਤ ਡਰੇ ਹੋਏ ਸੀ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ ਪਰੰਤੂ ਅੰਤ ਵਿੱਚ ਸਾਡਾ ਰੋਲ ਸਭ ਨੂੰ ਬਹੁਤ ਪਸੰਦ ਆਇਆ ਅਤੇ ਉਸ ਸਮੇਂ ਮੇਰਾ ਪੂਰਾ ਪਰਿਵਾਰ ਇਸ ਫੰਕਸ਼ਨ ਨੂੰ ਦੇਖਣ ਵਾਸਤੇ ਪਹੁੰਚਿਆ ਹੋਇਆ ਸੀ ਰਿਹਸਲ ਪੂਰੀ ਹੋਣ ਤੋਂ ਬਾਅਦ ਸਾਡੀ ਕਲਾਸ ਇੰਚਾਰਜ ਅਧਿਆਪਕ ਨੇ ਸਾਡਾ ਸਕਿੱਟ ਸਾਡੀ ਮੁੱਖ ਅਧਿਆਪਕਾ ਜੀ ਨੂੰ ਦਿਖਾਇਆ ਅਤੇ ਸਾਰਿਆਂ ਨੂੰ ਸਟੇਜ ਦੇ ਉੱਪਰ ਇਹ ਸਕਿੱਟ ਕਰਨ ਲਈ ਕਿਹਾ ਉਹਨਾਂ ਨੇ ਪੂਰਨ ਤੌਰ 'ਤੇ ਇਸ ਨੂੰ ਓਕੇ ਕਰ ਦਿੱਤਾ ਤਾਂ ਸਾਨੂੰ ਕੁਝ ਰਾਹਤ ਮਹਿਸੂਸ ਹੋਈ ਅਤੇ ਸਾਡਾ ਡਰ ਕੁਝ ਹੱਦ ਤੱਕ ਘੱਟ ਹੋ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬਹੁਤ ਵਧੀਆ ਪਰਫੋਰਮ ਕੀਤਾ ਹੈ ਅਸੀਂ ਵਧੀਆ ਪਰਫੋਰਮ ਕਰ ਸਕਦੇ ਹਾਂ ਫੰਕਸ਼ਨ ਵਾਲੇ ਦਿਨ ਅਸੀਂ ਬਹੁਤ ਵਧੀਆ ਪਰਫੋਰਮ ਕੀਤਾ ਸਭ ਨੇ ਬਹੁਤ ਹੱਲਾਸ਼ੇਰੀ ਦਿੱਤੀ ਮੇਰੇ ਮਾਂ ਬਾਪ ਵੀ ਇਹ ਸਕਿਟ ਦੇਖ ਕੇ ਬਹੁਤ ਖੁਸ਼ ਹੋਏ ਇਸ ਗੱਲ ਨੂੰ ਹੋਏ ਬਹੁਤ ਸਮਾਂ ਬੀਤ ਗਿਆ ਹੈ ਅੱਜ ਮੈਂ ਆਪਣੇ ਯਾਦਾਂ ਦੇ ਵਿੱਚ ਉਹ ਸਮਾਂ ਯਾਦ ਕਰਦੀ ਹਾਂ ਜਦੋਂ ਮੈਂ ਸਕੂਲ ਵਿੱਚ ਹੁੰਦੀ ਸੀ ਅਤੇ ਸੱਤਵੀਂ ਵਿੱਚ ਪੜ੍ਹਦੀ ਸੀ ਮੈਂ ਉਸ ਸਮੇਂ ਮਲਕੀ ਕੀਮਾ ਨਾਮ ਦਾ ਸਕਿੱਟ ਕੀਤਾ ਅਤੇ ਉਸ ਵਿੱਚ ਮਲਕੀ ਦਾ ਰੋਲ ਅਦਾ ਕੀਤਾ ਸੀ ਉਸ ਫੰਕਸ਼ਨ ਵਿੱਚ ਮੈਂ ਸਕਿੱਟ ਤੋਂ ਬਾਅਦ ਸ਼ਬਦ ਗਾਇਨ ਵਿੱਚ ਵੀ ਭਾਗ ਲਿਆ ਸੀ ਜਿਸ ਵਿੱਚ ਮੈਨੇ ਗੁਰੂ ਗੋਬਿੰਦ ਸਿੰਘ ਜੀ ਦਾ ਗਾਇਆ ਹੋਇਆ ਸ਼ਬਦ ਗਾਇਆ ਸੀ ਦੇਹ ਸ਼ਿਵਾ ਵਰ ਮੋਹ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ਮੈਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਸੀ ਅਤੇ ਮੈਨੂੰ ਟਰੋਫੀ ਵੀ ਮਿਲੀ ਸੀ ਅੱਜ ਦੇ ਸਮੇਂ ਵਿੱਚ ਮੈਂ ਆਪਣੀ ਧੀ ਨੂੰ ਵੀ ਇਹਨਾਂ ਕੰਮਾਂ ਵੱਲ ਪ੍ਰੇਰਿਤ ਕਰਦੀ ਹਾਂ ਉਸ ਨੂੰ ਹੱਲਾਸ਼ੇਰੀ ਦਿੰਦੀ ਹਾਂ ਕਿ ਉਹ ਵੀ ਨਾਟਕਾਂ ਵਿੱਚ ਸਕੂਲ ਵਿੱਚ ਹਿੱਸਾ ਲਵੇ ਸ਼ਬਦ ਗਾਇਨ ਵਿੱਚ ਹਿੱਸਾ ਲਵੇ ਅਤੇ ਫੰਕਸ਼ਨ ਵਿੱਚ ਵੀ ਹਿੱਸਾ ਲਵੇ ਇਸ ਤੋਂ ਪਿੱਛੋਂ ਮੇਰੀ ਧੀ ਨੇ ਸਕੂਲ ਦੇ ਕਈ ਫੰਕਸ਼ਨਾਂ ਵਿੱਚ ਹਿੱਸਾ ਲਿਆ ਅਤੇ ਉਸਨੇ ਹਿੰਦੀ ਗਾਣਿਆਂ ਦੇ ਉੱਤੇ ਵੀ ਡਾਂਸ ਕੀਤਾ ਪੰਜਾਬੀ ਗਾਣਿਆਂ ਉੱਤੇ ਵੀ ਡਾਂਸ ਕੀਤਾ ਕਵਾਲੀ ਵਿੱਚ ਵੀ ਹਿੱਸਾ ਲਿਆ ਅਤੇ ਉਸਨੇ ਧਾਰਮਿਕ ਗੱਤਕੇ ਵਿੱਚ ਵੀ ਆਪਣਾ ਹਿੱਸਾ ਪਾਇਆ ਫੰਕਸ਼ਨ ਵਿੱਚ ਭਾਗ ਲੈਣ ਤੋਂ ਪਹਿਲਾਂ ਉਹ ਬਹੁਤ ਡਰੀ ਹੋਈ ਸੀ ਪਰ ਭਾਗ ਲੈਣ ਤੋਂ ਬਾਅਦ ਉਸਦਾ ਡਰ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ